ਘਰ ਵਿੱਚ ਬਗੀਚੀ ਦੀ ਸਾਂਭ ਸੰਭਾਲ ਕਰਨਾ ਬਹੁਤ ਸਸਤਾ ਹੈ ਜੇਕਰ ਆਪਾਂ ਖੁਦ ਕਰੀਏ ਆਪਣੀ ਰੁਚੀ ਬਾਗ ਦੇ ਵਿੱਚ ਹੈ ਆਪਣੀ ਹੋਬੀ ਹੈ ਇਹ ਤਾਂ ਕੋਈ ਜ਼ਿਆਦਾ ਮਹਿੰਗਾ ਨਹੀਂ ਪੈਂਦਾ ਸਸਤਾ ਹੈ ਆਪਾਂ ਉਸ ਦੀ ਦਿਨ ਵ ਦਿਨ ਸਮੇਂ ਸਮੇਂ ਨਾਲ ਦੇਖਭਾਲ ਕਰੀਏ ਤਾਂ ਫਲ ਆਪਾਂ ਨੂੰ ਉਸਦਾ ਜ਼ਰੂਰ ਮਿਲਦਾ ਹੈ ਬਾਗ ਬਗੀਚੀ ਦੇ ਵਿੱਚ ਜਦੋਂ ਆਪਾਂ ਚੰਗੇ ਫਲ ਫਲਦਾਰ ਬੂਟੇ ਜਾਂ ਫੁੱਲ ਲਗਾਉਂਦੇ ਹਾਂ ਇੱਕ ਦਿਨ ਉਹ ਆਪਾਂ ਨੂੰ ਜ਼ਰੂਰ ਫਲ ਦਿੰਦੇ ਹਨ ਅਤੇ ਉਹ ਜਦੋਂ ਉਹ ਫਲ ਦਿੰਦੇ ਹਨ ਤਾਂ ਆਪਾਂ ਨੂੰ ਆਪਣੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੁੰਦਾ ਇਸ ਲਈ ਘਰ ਵਿੱਚ ਇੱਕ ਬਗੀਚੀ ਤਿਆਰ ਕਰਨ ਸਮੇਂ ਖੁਦ ਮਿਹਨਤ ਕਰੀਏ ਤਾਂ ਉਹ ਬਹੁਤ ਸਸਤੀ ਪੈਂਦੀ ਹੈ ਅਗਰ ਆਪਾਂ ਉਹ ਕਿਸੇ ਦੂਜੇ 'ਤੇ ਜਿਵੇਂ ਮਾਲੀ 'ਤੇ ਛੱਡ ਦਈਏ ਤਾਂ ਉਹ ਆਪਾਂ ਨੂੰ ਮਹਿੰਗੀ ਪਊਗੀ ਹੀ ਕਿਉਂਕਿ ਮਾਲੀ ਸਾਰਾ ਕੁਛ ਬਾਹਰੋਂ ਮੰਗਾਊਗਾ ਖਾਦ ਆਪਾਂ ਖੁਦ ਤਿਆਰ ਕਰੀਏ ਜਿਵੇਂ ਦਰਖਤਾਂ ਦੇ ਪੱਤੇ ਇਕੱਠੇ ਕਰੋ ਸਬਜ਼ੀਆਂ ਦੇ ਛਿਲਕੇ ਵਗੈਰਾ ਇਕੱਠੇ ਕਰਕੇ ਉਹਨਾਂ ਲਈ ਚੰਗੀ ਖਾਦ ਤਿਆਰ ਕਰੋ ਸਮੇਂ 'ਤੇ ਉਹਨਾਂ ਦੀ ਗੁਡਾਈ ਕਰੋ ਸਮੇਂ 'ਤੇ ਉਹਨਾਂ ਨੂੰ ਪਾਣੀ ਦਿਓ ਇਹ ਸਾਰਾ ਕੁਝ ਕਰਨ ਨਾਲ ਆਪਣੀ ਖੁਦ ਦੀ ਸਿਹਤ ਵੀ ਵਧੀਆ ਰਹਿੰਦੀ ਹੈ ਸਰੀਰ ਫਿਟ ਬਣਿਆ ਰਹਿੰਦਾ ਅਤੇ ਆਪਣੇ ਪੌਦੇ ਵੀ ਹਰੇ ਭਰੇ ਰਹਿੰਦੇ ਆ ਅਤੇ ਮਨ ਨੂੰ ਸ਼ਾਂਤੀ ਰਹਿੰਦੀ ਹੈ ਬਹੁਤ ਸਕੂਨ ਮਿਲਦਾ ਆਪਣੇ ਸਰੀਰ ਨੂੰ ਕੋਈ ਵੀ ਰੋਗ ਨਹੀਂ ਲੱਗਦਾ ਆਹ ਫਾਲਤੂ ਕੰਮਾਂ ਤੋਂ ਆਪਾਂ ਫਾਲਤੂ ਕੰਮਾਂ ਤੋਂ ਆਪਾਂ ਬਚ ਜਾਂਦੇ